ਮੈਂ ਮਮਤਾ ਦੇਵੀ ਪਿੰਡ ਮਾਧੋਪੁਰ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਪੰਜਾਬੀ ਭਾਸ਼ਾ ਨੂੰ ਸਾਹਿਤ ਕਵਿਤਾ ਅਤੇ ਕਲਾਤਮਕ ਪ੍ਰਗਟਾਵੇ ਦੇ ਵਿੱਚ ਵਰਤਨ ਦਾ ਵਿਸ਼ੇਸ਼ ਤਰੀਕਾ ਹੈ ਜੋ ਇਸ ਨੂੰ ਇੱਕ ਸਿਰਜਨ ਅਤੇ ਸੰਵਿਧਾਨਤ ਭਾਵ ਵਿੱਚ ਤਿਆਰ ਕਰਦਾ ਹੈ ਇਸ ਭਾਵ ਨਾਲ ਲੋਕ ਕਥਾ ਕਹਾਣੀਆਂ ਕਵਿਤਾਵਾਂ ਨਾਟਕ ਗੀਤ ਸੰਗੀਤ ਚਿੱਤਰਕਾਰੀ ਅਤੇ ਹੋਰ ਹੁਨਰਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਸਭ ਕੁਝ ਲੋਕ ਲੋਕ ਵਿੱਚ ਜਨ ਪ੍ਰੀਤ ਅਤੇ ਸਮਰੱਥਾ ਨੂੰ ਦਿਖਾਉਂਦਾ ਹੈ ਸਮਾਜਿਕ ਸੁਸਾਇਟੀ ਅਤੇ ਸੰਸਾਰਿਕ ਮੁੱਦਿਆਂ ਨੂੰ ਪ੍ਰਭਾਵੀ ਕਰਨ ਵਿੱਚ ਮਦਦ ਕਰਦਾ ਹੈ ਇਸ ਤਰੀਕੇ ਨਾਲ ਪੰਜਾਬੀ ਭਾਸ਼ਾ ਵਿੱਚ ਵਿਕਾਸ ਅਤੇ ਸੁਧਾਰ ਦੇ ਮਾਧਿਅਮ ਦੇ ਤੌਰ 'ਤੇ ਸਾਹਿਤਕ ਅਤੇ ਕਲਾਤਮਕ ਧਾਰਨਾਵਾਂ ਅਤੇ ਪ੍ਰਤੀ ਚੇਤਨ ਚੇਤਨਾ ਬਣਾਉਣ ਲਈ ਸਾਹਿਤਕ ਸੰਸਾਰਿਕ ਅਤੇ ਸਮਾਜਿਕ ਸਮਾਜ ਦੇ ਸਾਥੀਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ